ਫਤਿਹਗੜ੍ਹ ਸਾਹਿਬ ਜ਼ਿਲ੍ਹਾ ਛੋਟਾ ਹੋਣ ਕਰਕੇ ਇੱਥੇ ਰੋਜ਼ਗਾਰ ਅਤੇ ਰੋਟੀ ਰੋਜ਼ੀ ਦੇ ਸਰੋਤ ਬਹੁਤ ਘੱਟ ਨੇ ਪ੍ਰੰਤੂ ਅਸੀਂ ਛੋਟੇ ਛੋਟੇ ਬਹੁਤ ਕੰਮ ਕਰ ਸਕਦੇ ਹਾਂ ਕਿਉਂਕਿ ਸਾਡੇ ਆਲੇ ਦੁਆਲੇ ਬੜੇ ਸ਼ਹਿਰ ਲੱਗਦੇ ਹੋਣ ਕਰਕੇ ਸਾਨੂੰ ਛੋਟੇ ਕੰਮਾਂ ਦਾ ਬਹੁਤ ਫਾਇਦਾ ਹੋ ਸਕਦਾ ਹੈ ਅਸੀਂ ਗੱਡੀ ਵਿੱਚ ਘਰ ਤੋਂ ਦੁਪਹਿਰ ਦਾ ਖਾਣਾ ਤਿਆਰ ਕਰਕੇ ਕਿਸੇ ਵੀ ਸੰਸਥਾ ਦੇ ਬਾਹਰ ਜਾ ਕੇ ਵੇਚ ਸਕਦੇ ਹਾਂ ਜਾਂ ਘਰ ਤੋਂ ਵੀ ਟਿਫਨ ਸਰਵਿਸ ਸ਼ੁਰੂ ਕਰ ਸਕਦੇ ਹਾਂ ਅਤੇ ਕੈਬ ਦਾ ਕੰਮ ਵੀ ਕਰ ਸਕਦੇ ਹਾਂ ਛੋਟੇ ਛੋਟੇ ਕੰਮ ਜਿਵੇਂ ਕਿ ਸੇਵੀਆਂ ਅਚਾਰ ਚਟਨੀ ਮੁਰੱਬਾ ਅਤੇ ਹੋਰ ਬਹੁਤ ਕੁਝ ਕ੍ਰਿਸ਼ੀ ਵਿਗਿਆਨ ਤੋਂ ਸਿਖਲਾਈ ਲੈ ਕੇ ਅਤੇ ਗਰੁੱਪ ਬਣਾ ਕੇ ਸ਼ੁਰੂ ਕਰ ਸਕਦੇ ਹਾਂ ਘਰ ਵਿੱਚ ਮੁਰਗੀ ਪਾਲਣਾ ਬੱਕਰੀਆਂ ਅਤੇ ਸੂਰ ਪਾਲਣ ਦਾ ਧੰਦਾ ਵੀ ਕਰ ਸਕਦੇ ਹਾਂ ਅਤੇ ਵਧੀਆ ਮੁਨਾਫਾ ਲੈ ਸਕਦੇ ਹਾਂ ਇੱਕ ਵਧੀਆ ਧੰਦਾ ਸਿਲਾਈ ਦਾ ਵੀ ਹੈ ਖਰਚਾ ਬਹੁਤ ਘੱਟ ਅਤੇ ਮਿਹਨਤ ਵਧੀਆ ਮਿਲਦੀ ਹੈ ਘੱਟ ਪੜ੍ਹੇ ਲਿਖੇ ਲੋਕ ਪ੍ਰੈੱਸ ਦਾ ਕੰਮ ਕਰ ਸਕਦੇ ਹੈ ਅਤੇ ਵਧੀਆ ਮੁਨਾਫਾ ਕਮਾ ਸਕਦੇ ਹਨ ਬੇਕਰੀ ਦੇ ਕੰਮ ਵਿੱਚ ਵੀ ਵਧੀਆ ਕਮਾਈ ਹੈ ਜੋ ਕਿ ਅਸੀਂ ਫੋਨ 'ਤੇ ਕਿਸੇ ਵੀ ਐਪ 'ਤੇ ਪੇਜ਼ ਬਣਾ ਕੇ ਵਧੀਆ ਮੁਨਾਫ਼ਾ ਕਮਾ ਸਕਦੇ ਹਾਂ ਬਾਕੀ ਅੱਜ ਕੱਲ੍ਹ ਪੱਖੀਆਂ ਦਾ ਬਹੁਤ ਫੈਸ਼ਨ ਹੈ ਅਸੀਂ ਪੱਖੀਆਂ ਨਾਲੇ ਦਰੀਆਂ ਸਵੈਟਰ ਬੁਣਨ ਦਾ ਕੰਮ ਕਰਕੇ ਵਧੀਆ ਕਮਾ ਸਕਦੇ ਹਾਂ ਅਸੀਂ ਕ੍ਰਿ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਹਾਇਤਾ ਨਾਲ ਕਿਚਨ ਗਾਰਡਨ ਵਿੱਚ ਔਰਗੈਨਿਕ ਸਬਜ਼ੀਆਂ ਫਲ ਫੁੱਲਾਂ ਦੀ ਪੈਦਾਵਾਰ ਕਰਕੇ ਉਹਨਾਂ ਨੂੰ ਬਾਹਰ ਵੇਚ ਸਕਦੇ ਹਾਂ ਅਤੇ ਵਧੀਆ ਮੁਨਾਫ਼ਾ ਕਮਾ ਸਕਦੇ ਹਾਂ